ਪੰਜਾਬ ਇੱਕ ਬਹੁਤ ਹੀ ਸੱਭਿਆਚਾਰਕ ਅਸਥਾਨ ਹੈ ਜਿੱਥੇ ਕਿ ਪੰਜਾਬੀ ਲੋਕ ਸ਼ੁਰੂ ਤੋਂ ਹੀ ਆਪਣੇ ਸੱਭਿਆਚਾਰ ਨੂੰ ਵਰਤਦੇ ਆ ਰਹੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਪਜਾਮੇ ਕੁੜਤੇ ਅਤੇ ਪੱਗਾਂ ਬੰਨਦੇ ਹਨ ਜੋ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਉਹ ਖੇਤੀ ਵੀ ਕਰਦੇ ਹਨ ਉਹ ਵੀ ਸਾਡੇ ਸੱਭਿਆਚਾਰ ਦੇ ਵਿੱਚ ਹੀ ਆਉਂਦਾ ਹੈ ਅਤੇ ਸਾਡੇ ਪੰਜਾਬ ਦੀਆਂ ਔਰਤਾਂ ਸਲਵਾਰ ਕੁੜਤਾ ਅਤੇ ਫੁਲਕਾਰੀ ਲੈਂਦੀਆਂ ਹਨ ਜੋ ਕਿ ਸਾਡੀ ਸੱਭਿਅਤਾ ਹੈ ਅਤੇ ਉਹ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਬਣਾਉਂਦੀਆਂ ਹਨ ਜਿਹੜੀਆਂ ਕਿ ਸਾਡੇ ਸਮਾਜਿਕ ਵਿੱਚ ਨਿਯਮਾਂ ਦੇ ਵਿੱਚ ਹੀ ਆਉਂਦੀਆਂ ਹਨ